ਬਾਈ ਅਗਸਤ ਦੋ ਹਜ਼ਾਰ ਇੱਕ ਬਾਰ੍ਹਾਂ ਨਵੰਬਰ ਉੱਨੀ ਸੌ ਚੌਂਹਠ ਤੀਹ ਅਕਤੂਬਰ ਦੋ ਹਜ਼ਾਰ ਤੇਰ੍ਹਾਂ ਦੋ ਜਨਵਰੀ ਦੋ ਹਜ਼ਾਰ ਤੇਈ ਸੋਲ੍ਹਾਂ ਸਤੰਬਰ ਉੱਨੀ ਸੌ ਪਚਾਨਵੇਂ